ਹੈਲੋ ਮੈਂ ਸੋਨੀਆ ਗੱਲ ਕਰ ਰਹੀ ਹਾਂ ਕੀ ਤੁਸੀਂ ਲੈਬ ਏਜੰਸੀ ਟਰੈਵਲ ਤੋਂ ਬੋਲ ਰਹੇ ਹੋ ਅਸਲ ਵਿੱਚ ਮੈਂ ਮੈਂ ਇੱਕ ਕੈਬ ਬੁੱਕ ਕਰਨੀ ਸੀ ਫਤਿਹਗੜ੍ਹ ਅਤੇ ਫਤਿਹਗੜ੍ਹ ਸਾਹਿਬ ਅਤੇ ਰਾਜਪੁਰੇ ਤੋਂ ਰਾਜਪੁਰੇ ਤੱਕ ਅਤੇ ਮੇਰੀ ਇੱਛਾ ਕਿ ਤੁਸੀਂ ਮੈਨੂੰ ਨੇੜੇ ਦੇ ਵਾਹਨਾਂ ਵਿੱਚੋਂ ਕੋਈ ਕੈਬ ਬੁੱਕ ਕਰ ਦਿੰਦੇ ਹੋ ਤਾਂ ਮੈਂ ਤੁਹਾਡੀ ਬਹੁਤ ਧੰਨਵਾਦੀ ਹੋਵਾਂਗੀ ਮੇਰੇ ਰਾਜਨ ਫਾਸਟ ਫੂਡ ਜੋ ਕਿ ਬੰਦਾ ਬਹਾਦਰ ਕੋਲਜ ਦੇ ਸਾਹਮਣੇ ਹੈ ਉੱਥੇ ਬੰਦਾ ਬਹਾਦਰ ਦਾ ਸਟੇਟਸ ਵੀ ਹੈ ਅਤੇ ਟਰੈਫਿਕ ਲਾਈਟਸ ਵੀ ਮੌਜੂਦ ਹਨ ਜੋਤੀ ਸਰੂਪ ਚੌਂਕ ਦੇ ਨਜ਼ਦੀਕ ਹੈ ਅਸਲ ਵਿੱਚ ਮੈਂ ਰਾਜਪੁਰੇ ਪਹੁੰਚਣਾ ਹੈ ਤਕਰੀਬਨ ਪੰਤਾਲੀ ਮਿੰਟ ਵਿੱਚ ਮੈਂ ਉੱਥੇ ਜੋਬ ਕਰਦੀ ਹਾਂ ਅਤੇ ਅਚਾਨਕ ਹੀ ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਹੈ ਇਸ ਕਰਕੇ ਮੈਨੂੰ ਫਤਿਹਗੜ੍ਹ ਸਾਹਿਬ ਆਉਣਾ ਪਿਆ ਪਰ ਹੁਣ ਮੇਰੇ ਆਫਿਸ ਵਿੱਚੋਂ ਕਾਲ ਆਈ ਹੈ ਕਿ ਮੈਨੂੰ ਇੱਕ ਜ਼ਰੂਰੀ ਮੀਟਿੰਗ ਅਟੈਂਡ ਕਰਨੀ ਪਵੇਗੀ ਜਿਸ ਕਰਕੇ ਮੈਨੂੰ ਜਲਦੀ ਪਹੁੰਚਣਾ ਹੈ ਪਲੀਜ ਕੋਈ ਕੈਬ ਜੋ ਨੇੜੇ ਦੇ ਏਰੀਏ ਵਿੱਚ ਹੋਵੇ ਮੈਨੂੰ ਉਹ ਅਵੇਲੇਬਲ ਕਰਵਾਈ ਜਾਵੇ ਤਾਂ ਜੋ ਮੈਂ ਉੱਥੇ ਟਾਈਮ 'ਤੇ ਪਹੁੰਚ ਸਕਾਂ ਮੈਂ ਤੁਹਾਡੀ ਬਹੁਤ ਥੈਂਕਫੁੱਲ ਹੋਵਾਂਗੀ